ਹੈਲੋ ਹੈਲੋ ਵਧੀਆ ਤੂੰ ਦੱਸ ਕਿਵੇਂ ਆ ਮੈਂ ਵਧੀ ਬਸ ਕੁਛ ਨਹੀਂ ਮੈਂ ਮਤਲਬ ਮੇਰੀ ਫਰੈਂਡਸ ਆਈ ਵੀ ਸੀ ਮੈਂ ਉਹਨਾਂ ਨੂੰ ਆਪਣੀ ਯੂਨੀਵਰਸਿਟੀ ਬਾਰੇ ਦੱਸ ਰਹੀ ਸੀ ਅਤੇ ਆਪਣੀ ਯੂਨੀਵਰਸਿਟੀ ਵੀ ਫੈਕਲਟੀ ਕਿੰਨੀ ਵਧੀਆ ਟੀਚਰਸ ਨੇ ਕੋਆਪਰੇਟਿਵ ਨੇ

ਹਾਂ ਕਿਸੇ ਫੈਕਲਟੀ ਦੀ ਜਦੋਂ ਲਾਸਟ ਟਾਈਮ ਆਪਣੀ ਕਲਾਸ ਨੂੰ ਕੋਈ ਕਨਸੋਨ ਆਇਆ ਸੀ ਤਾਂ ਉਹਨਾਂ ਨੇ ਆਪਣੀ ਕਿੰਨੀ ਵਧੀਆ ਤਰੀਕੇ ਨਾਲ ਗੱਲ ਸੁਣੀ ਸਾਰੀ ਸੋਲਵ ਕਰ ਤਾ ਇੱਕਦਮ ਹਾਂ ਲਾਈਬ੍ਰੇਰੀ ਵਧੀਆ ਚੱਲ ਰਹੀ ਹੈ ਹਰ ਤਰ੍ਹਾਂ ਦੀਆਂ ਬੁੱਕਸ ਨੋਵਲਸ ਬੱਚਾ ਰੀਡ ਕਰ ਸਕਦਾ ਆਉਣ ਜਾਣ ਲਈ ਜਿਹੜੇ ਬੱਚੇ ਦੂਰ ਰਹਿੰਦੇ ਆ ਵੈਨਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਵੀ ਕੋਈ ਦਿੱਕਤ ਨਾ ਆਵੇ ਕਿਸੇ ਨੂੰ ਹਾਂ ਆਪਣੇ ਅੱਜ ਇੱਥੇ ਸੈਮੀਨਾਰ ਲੱਗਿਆ ਸੀ ਕਾਲਜ ਡੀ ਆਈ ਐਸ ਦਾ ਹਾਂਜੀ ਉਹੀ ਬਸ ਕਿ ਜਿਵੇਂ ਨੋਰਮਲ ਆਪਾਂ ਨੂੰ ਆਪਣੇ ਕਰੀਅਰ ਲਈ ਗਾਈਡੈਂਸ ਦਿੱਤੀ ਗਈ ਕੀ ਕਰ ਸਕਦੇ ਹਾਂ ਆਪਾਂ ਅੱਗੇ ਹੋਰ ਬਾਕੀ ਮੇਰੀ ਵੀ ਜਿਹੜੀ ਫਰੈਂਡ ਆ ਰੱਖੀ ਆ ਕਹਿ ਰਹੀ ਸੀ ਕਿ ਨੈਕਸਟ ਈਯਰ ਉਹਨੇ ਐਡਮਿਸ਼ਨ ਕਰਵਾਉਣੀ ਆ ਤਾਂ ਹੀ ਆਈ ਸੀ ਕਿ ਮੈਂ ਇੱਥੇ ਐਡਮਿਸ਼ਨ ਕਿੱਦਾਂ ਕਰਵਾ ਸਕਦੀ ਹਾਂ ਉਹ ਦੀਆਂ ਫੈਸਿਲਿਟੀਜ ਬਾਰੇ ਕਿਵੇਂ ਪਤਾ ਲੱਗਦਾ ਇਹ ਸਾਰੀਆਂ ਫੈਸਿਲਿਟੀਜ ਦੱਸ ਦਿਓ ਫੀਸ ਸਟਰਕਚਰ ਕੀ ਹੈ ਇਹਨਾਂ ਦਾ ਵੈਨ ਪ੍ਰੋਵਾਈਡ ਸਾਰੀਆਂ ਗੱਲਾਂ ਹੂੰ ਸਹੀ ਗੱਲ ਹੈ ਗਰਾਊਂਡ ਗੇ ਗੇਮਸ ਲਈ ਬੱਚਿਆਂ ਲਈ ਕਿੰਨੇ ਕਿਸੇ ਕੋਈ ਸੋਫਟ ਬਾਲ ਬਾਸਕਿਟ ਬਾਲ ਜਿਹਨੂੰ ਜਿਹੜੀ ਗੇਮ 'ਚ ਵੀ ਇੰਟਰਸਟ ਆ ਉਹ ਪਾਰਟ ਲੈ ਸਕਦੇ ਆ ਪਾਰਟ ਲੈ ਸਕਦੇ ਹੈ ਹੂੰ ਮਤਲਬ ਹਰ ਚੀਜ਼ ਪ੍ਰੋਵਾਇਡ ਪ੍ਰੋਪਰ ਜਿੰਨਾ ਮਤਲਬ ਬਹੁਤ ਵਧੀਆ ਡਿਸਿਪਲਨ ਹੈ ਸਾਰੇ ਬੱਚੇ ਵੀ ਇੱਕ ਦੂਜੇ ਨਾਲ ਇੰਨਾ ਵਧੀਆ ਕੋਪਰੇਟ ਕਰਕੇ ਚੱਲਦੇ ਆ ਜੇ ਕਿਸੇ ਨੂੰ ਕੋਈ ਵੀ ਲੋੜ ਹੈ ਤਾਂ ਇੰਨੇ ਹੈਲਥਪੁਲ ਹੈ ਸਾਰੇ ਬੱਚੇ ਹਾਂ ਬਿਕੋਜ਼ ਮੈਂ ਆਪਣੇ ਉੱਥੇ ਰਣਜੀਤ ਸਰ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਇੱਕ ਉਹਨਾਂ ਨੇ ਮੈਨੂੰ ਪੀ ਡੀ ਐਫ ਭੇਜੀ ਸੀ ਰਿਕਾਰਡਿੰਗ ਟੂ ਸਿਲੇਬਸ ਕਿ ਇਹਦੇ ਨਾਲ ਬੱਚਿਆਂ ਦਾ ਇੰਟਰੈਂਸ ਟੈਸਟ ਹੋਵੇਗਾ ਜਿਹਦੇ ਨਾਲ ਇਹ ਕਲੀਅਰ ਕਰਨਗੇ ਫਿਰ ਹੀ ਐਡਮਿਸ਼ਨ ਮਿਲੇਗੀ ਹਾਂ ਉਹ ਕੀ ਮੈਂ ਕਹਿ ਰਹੀ ਸੀ ਕਿ ਸਰ ਕਹਿੰਦੇ ਸੀ ਕਿ ਮਤਲਬ ਕਿ ਜਿਹੜੀ ਪ੍ਰੈਪਰੇਸ਼ਨ ਹੈ ਪੇਪਰ ਦੀ ਵਧੀਆ ਤਰੀਕੇ ਨਾਲ ਕਰਵਾ ਦਿਓ ਕਿ ਤਾਂ ਜਿਹੜਾ ਇੰਟਰੈਂਸ ਵਧੀਆ ਹੋ ਜੇ ਅਤੇ ਐਡਮਿਸ਼ਨ ਸੌਖੀ ਮਿਲ ਜਾਵੇ ਅਤੇ ਜਿਹਦੇ ਨੰਬਰ ਵਧੀਆ ਆਉਣਗੇ ਉਹ ਬੱਚਿਆਂ ਨੂੰ ਸਕੋਲਰਸ਼ਿਪ ਵੀ ਪ੍ਰੋਵਾਈਡ ਕਰਦੇ ਆ ਹਾਂ ਹਾਂ ਹਾਂ ਹਾਂ ਓਕੇ ਓਕੇ ਓਕੇ